ਮੇਰੀ ਮਨਪਸੰਦ ਕਲਾ ਚਿੱਤਰਕਾਰੀ ਹੈ ਮੈਂ ਬਹੁਤ ਸਾਰੇ ਚਿੱਤਰ ਬਣਾਏ ਹੋਏ ਹਨ ਪੱਚੀ ਮਾਰਚ ਦੋ ਹਜ਼ਾਰ ਚੌਵੀ ਨੂੰ ਮੇਰੇ ਸਕੂਲ ਵਿੱਚ ਚਿੱਤਰਕਾਰੀ ਦਾ ਪ੍ਰੋਗਰਾਮ ਸੀ ਮੈਂ ਉਸ ਪ੍ਰੋਗਰਾਮ ਵਿੱਚ ਭਾਗ ਲਿਆ ਉਸ ਪ੍ਰੋਗਰਾਮ ਵਿੱਚ ਮੈਂ ਰਾਧਾ ਕ੍ਰਿਸ਼ਨ ਦੀ ਚਿੱਤਰਕਾਰੀ ਕੀਤੀ ਚਿੱਤਰਕਾਰੀ ਬਣਾਉਣ ਲਈ ਮੈਨੂੰ ਸਿਰਫ ਤਿੰਨ ਘੰਟੇ ਦਾ ਸਮਾਂ ਹੀ ਮਿਲਿਆ ਸੀ ਉਸ ਪ੍ਰੋਗਰਾਮ ਵਿੱਚ ਮਸ਼ਹੂਰ ਚਿੱਤਰਕਾਰ ਸਿੱਖ ਸ਼ਰਮਾ ਆਏ ਹੋਏ ਸਨ ਮੈਂ ਉਨਾਂ ਦੀ ਚਿੱਤਰਕਾਰੀ ਤੋਂ ਕਾਫੀ ਪ੍ਰਭਾਵਿਤ ਹੋਈ ਸੀ ਕਿਉਂਕਿ ਉਹਨਾਂ ਦੀ ਚਿੱਤਰਕਾਰੀ ਬਹੁਤ ਹੀ ਵਧੀਆ ਹੁੰਦੀ ਹੈ ਉਹ ਚਿਤਰਕਾਰੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਣਾਉਂਦੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਉਹਨਾਂ ਵਰਗੀ ਚਿੱਤਰਕਾਰੀ ਬਣਾਉਣਾ ਚਾਹੁੰਦਾ ਹੈ ਮੈਂ ਵੀ ਉਹਨਾਂ ਦੀ ਚਿੱਤਰਕਾਰੀ ਤੋਂ ਪ੍ਰਭਾਵਿਤ ਹੋ ਕੇ ਚਿੱਤਰਕਾਰੀ ਕਰਨੀ ਸ਼ੁਰੂ ਕੀਤੀ ਅਤੇ ਜਦੋਂ ਮੈਂ ਉਸ ਪ੍ਰੋਗਰਾਮ ਪਿੱਛੋਂ ਚਿੱਤਰਕਾਰੀ ਕੀਤੀ ਤਾਂ ਉਹ ਮੇਰੀ ਉਸ ਚਿੱਤਰਕਾਰੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਮੈਂ ਆਪਣੀ ਚਿੱਤਰਕਾਰੀ ਨੂੰ ਸਮੇਂ ਤੋਂ ਪਹਿਲਾਂ ਹੀ ਬਣਾ ਲਿਆ ਸੀ ਉਹ ਮੇਰੀ ਇਸ ਕਲਾਕਾਰੀ ਨੂੰ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਕਰਨ ਲਈ ਕਿਹਾ